ਸਤਿ ਸ਼੍ਰੀ ਅਕਾਲ ਮੈਂ ਅਰਵਿੰਦ ਭਾਰਦਵਾਜ ਬੋਲਦਾ ਪਿਆ ਮੈਂ ਪਠਾਨਕੋਟ ਤੋਂ ਰਹਿਣ ਵਾਲਾ ਅਤੇ ਅੱਜ ਮੇਰੇ ਛੋਟੇ ਭਰਾ ਦਾ ਜਨਮਦਿਨ ਹੈਗਾ ਅਤੇ ਇਸ ਕਰਕੇ ਮੈਂ ਸਵੇਰੇ ਔਡਰ ਕਰਵਾਇਆ ਸੀਗਾ ਅਤੇ ਮੇਰਾ ਔਡਰ ਸੀਗਾ ਚਾਪ ਸੀਗੀ ਪਿਜ਼ਾ ਸੀਗੇ ਅਤੇ ਰਾਈਸ ਸੀਗੇ ਅਤੇ ਪਨੀਰ ਪਨੀਰ ਅਤੇ ਇੱਕ ਕੇਕ ਸੀਗਾ ਅਤੇ ਇਹ ਮੇਰੇ ਫ ਮੈਂ ਮੇਰੇ ਫੋਨ 'ਤੇ ਉਹਨੂੰ ਕੁਛ ਵੀ ਸ਼ੋ ਨਹੀਂ ਹੋ ਰਿਹਾ ਜਿਸ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਮੇਰਾ ਕਿਤੇ ਔਡਰ ਕੈਂਸਲ ਨਹੀਂ ਹੋ ਹੋ ਗਿਆ ਹੈ ਅਤੇ ਇਹ ਕਿਤੇ ਇਹ ਤਾਂ ਇਹ ਮੈਨੂੰ ਇਹ ਵੀ ਦੱਸਿਆ ਜਾਵੇ ਕਿ ਜਿਹੜਾ ਔਡਰ ਆ ਇਹ ਤੁਹਾਡੇ ਤੱਕ ਪੁੱਜਿਆ ਵੀ ਹੈਗਾ ਕਿ ਨਹੀਂ ਅਤੇ ਇਹ ਮੈਨੂੰ ਜਲਦ ਤੋਂ ਜਲਦ ਇਹ ਦੱਸਿਆ ਜਾਵੇ ਕਿ ਜਿਹੜਾ ਔਡਰ ਹੈਗਾ ਇਹ ਮੇਰੇ ਤੱਕ ਕਿੰਨੀ ਦੇਰ ਤੱਕ ਪੁੱਜ ਜਾਵੇ ਕਿਉਂਕਿ ਮੈਂ ਜਿਹੜੇ ਮੇਰੇ ਘਰ ਮਹਿਮਾਨ ਹੈਗੇ ਆ ਉਹ ਜਿਹੜੇ ਉਹ ਆ ਪਹੁੰਚ ਚੁੱਕੇ ਦੇ ਆ ਇਸ ਕਰਕੇ ਮੇਰੇ ਘਰ ਦੇ ਮੈਨੂੰ ਬੋਲ ਰਹੇ ਆ ਕਿ ਤੁਸੀਂ ਇਹ ਜਿਹੜਾ ਔਡਰ ਹੈਗਾ ਇਹ ਕਿੰਨੀ ਦੇਰ ਤੱਕ ਆਏਗਾ ਅਤੇ ਮੇਰਾ ਇਹੀ ਹੈਗਾ ਕਿ ਜਲਦੀ ਤੋਂ ਜ ਜਲਦੀ ਜਿਹੜਾ ਔਡਰ ਹੈਗਾ ਨਾ ਉਹ ਮੇਰੇ ਤੱਕ ਪਹੁੰਚਾਇਆ ਜਾਵੇ ਅਤੇ ਜਦੋਂ ਨਾਲ ਹੀ ਜਦੋਂ ਔਡਰ ਆ ਜਾਵੇਗਾ ਨਾਲ ਹੀ ਮੈਂ ਤੁਹਾਨੂੰ ਉਸ ਵਕਤ ਪੇਮੈਂਟ ਕਰ ਦਿੰਦਾ ਤਾਂ ਆਪ ਧੰਨਵਾਦ